ਹਾਂਜੀ ਸਾਡੇ ਪਿੰਡ ਵਿੱਚ ਇੱਕ ਭਜਨ ਮੰਡਲੀ ਹੈ ਓਹ ਹਰ ਐਤਵਾਰ ਸਾਡੇ ਪਿੰਡ ਦੀ ਇੱਕ ਧਰਮਸ਼ਾਲਾ ਵਿੱਚ ਇਕੱਠੇ ਹੁੰਦੇ ਹਨ ਅਤੇ ਭਜਨ ਕਰਦੇ ਹਨ ਜਦੋਂ ਉਹ ਭਜਨ ਕਰਦੇ ਹਨ ਤਾਂ ਸਾਡੇ ਪਿੰਡ ਦੇ ਲੋਕ ਉਹਨਾਂ ਦੇ ਭਜਨ ਸੁਣਦੇ ਹਨ ਅਤੇ ਆਨੰਦ ਲੈਂਦੇ ਹਨ ਉਹਨਾਂ ਕੋਲ ਜਿਹੜੇ ਸੰਗੀਤ ਯੰਤਰ ਹੁੰਦੇ ਹਨ ਉਹ ਹਰਮੋਨੀਅਮ ਵਾਜਾ ਢੋਲਕੀ ਛੈਣੇ ਚਿਮਟੇ ਅਤੇ ਹੋਰ ਕਈ ਪ੍ਰਕਾਰ ਦੇ ਯੰਤਰ ਹੁੰਦੇ ਹਨ